ਹਾਂਜੀ ਮੈਂ ਵਰਚੁਅਲ ਰਿਐਲੀਟੀ ਗੇਮ ਖੇਡੀ ਹੈ ਜਿਨ੍ਹਾਂ ਵਿੱਚੋਂ ਸਭ ਤੋਂ ਮੇਰੀ ਫ਼ੇਵਰਟ ਹੈਗੀ ਹੈ ਲੂਡੋ ਜਿਹੜੀ ਕਿ ਅਸੀਂ ਦੋ ਬੰਦੇ ਚਾਰ ਬੰਦੇ ਜਿਹੜੇ ਇੱਕ ਸਮੇਂ 'ਤੇ ਖੇਡ ਸਕਦੇ ਹਨ ਇਹ ਗੇਮ ਬਹੁਤ ਹੀ ਵਧੀਆ ਹੈ ਅਸੀਂ ਇਕੱਠੇ ਬਹਿ ਕੇ ਜਿਹੜਾ ਹੈ ਪੂਰੀ ਤਰ੍ਹਾਂ ਇੱਕ ਦੂਜੇ ਨੂੰ ਇੰਟਰਟੇਨ ਕਰਦੇ ਹਨ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚੋਂ ਕਿਹੜਾ ਪਹਿਲੇ ਨੰਬਰ 'ਤੇ ਆਵੇਗਾ ਕਿਹੜਾ ਦੂਜੇ ਨੰਬਰ 'ਤੇ ਆਵੇਗਾ ਐਵੇਂ ਦੀਆਂ ਸ਼ਰਤਾਂ ਲਗਾਉਂਦੇ ਹਨ ਅਤੇ ਇਹ ਗੇਮ ਜਿਹੜੀ ਹੈ ਬਹੁਤ ਹੀ ਵਧੀਆ ਹੈ ਜ਼ਿਆਦਾਤਰ ਜਿਹੜੇ ਬੱਚੇ ਹੈ ਜਾਂ ਯੰਗਸਟਰ ਵੀ ਹੈ ਉਹ ਇਸ ਗੇਮ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੈ ਅਤੇ ਮੈਂ ਜ਼ਿਆਦਾਤਰ ਦੇਖਿਆ ਆਫਿਸ ਦੇ ਵਿੱਚ ਵਿਹਲੇ ਟਾਇਮ ਅਸੀਂ ਲੂਡੋ ਨੂੰ ਪਰੇਫ਼ਰ ਕਰਦੇ ਹਾਂ